ਖੇਤੀ ਵਿੱਚ ਹੁਣ ਬਹੁਤ ਹੀ ਜ਼ਿਆਦਾ ਤਨਕ ਤਕਨੀਕਾਂ ਅਪਣਾਈਆਂ ਜਾ ਰਹੀਆਂ ਹਨ ਪਹਿਲਾਂ ਜੋ ਖੇਤੀ ਬਲਦਾਂ ਰਾਹੀਂ ਹੁੰਦੀ ਸੀ ਹੁਣ ਉਹ ਟਰੈਕਟਰਾਂ ਰਾਹੀਂ ਹੁੰਦੀ ਹੈ ਇਸ ਤੋਂ ਇਲਾਵਾ ਹੁਣ ਜੋ ਵੀ ਨਵੇਂ ਟਰੈਕਟਰ ਦੇ ਸੰਦ ਆ ਰਹੇ ਹਨ ਉਹ ਵੀ ਇੰਟਰਨੈੱਟ ਦੇ ਨਾਲ ਕੰਮ ਕਰਦੇ ਹਨ ਜਿਨ੍ਹਾਂ ਨਾਲ ਕਿ ਜ਼ਮੀਨ ਦੀ ਲੇਵਲਿੰਗ ਕਰਨੀ ਹੋਵੇ ਚਾਹੇ ਜ਼ਮੀਨ ਦੀ ਖੁਦਾਈ ਕਰਨੀ ਹੋਵੇ ਉਹ ਸਾਰੇ ਕੰਮ ਬਹੁਤ ਹੀ ਵਧੀਆ ਢੰਗ ਨਾਲ ਹੋ ਰਹੇ ਹਨ